ਮੇਰਾ ਮਨ ਪਸੰਦ ਅਜੀਤ ਰਸਾਲਾ ਗਾ ਇਹਦੇ ਵਿੱਚ ਸਾਰੇ ਸਾਰੇ ਦੇਸ਼ ਭਰ ਦੀਆਂ ਖਬਰਾਂ ਵਗੈਰਾ ਦਿੱਤੀਆਂ ਜਾਂਦੀਆਂ ਯਾਨੀ ਕਿ ਸਾਰਿਆਂ ਦੀ ਅਤੇ ਹੋਰ ਇਹ ਵਧੀਆ ਹੁੰਦਾ ਗਾ ਅਤੇ ਸੱਚ ਹੀ ਲਿਖਿਆ ਜਾਂਦਾ ਇਹਦੇ ਵਿੱਚ ਅਤੇ ਬਾਕੀ ਗੱਲ ਇਹ ਸਾਰੇ ਬਾਰੇ ਦੱਸਿਆ ਜਾਂਦਾ ਹੈ ਇਹਨੂੰ ਇਹਨਾਂ ਵਿੱਚ ਜਿਵੇਂ ਮਤਲਬ ਕਿ ਜਿਵੇਂ ਜਾਂ ਕੋਈ ਚੀਜ਼ ਵਗੈਰਾ ਕੋਈ ਮਤਲਬ ਗੱਡੀ ਵਗੈਰਾ ਲੌਂਚ ਹੁੰਦੀ ਹੈ ਉਹਦੇ ਬਾਰੇ ਵੀ ਇਹਦੇ ਵਿੱਚ ਖਬਰ ਆ ਜਾਂਦੀ ਆ ਅਤੇ ਜਾਂ ਜਿਸ ਤਰ੍ਹਾਂ ਮਤਲਬ ਕਿ ਵੀ ਕੋਈ ਹੋਰ ਆ ਕੋਈ ਵੀ ਮਤਲਬ ਕਿ ਵੀ ਖਬਰ ਆ ਜਾਂ ਕਿਸੇ ਦੇ ਵੀ ਕਿਸਾਨਾਂ ਦੀ ਕੋਈ ਖਬਰ ਹੁੰਦੀ ਹੈ ਮਤਲਬ ਕਿ ਜਾਂ ਜਾਨੀ ਕਿ ਵੀ ਦੂਜਾ ਕੋਈ ਵੀ ਉਹ ਹੁੰਦਾ ਗਾ ਆਪਣਾ ਹਰੇਕ ਦੇਸ਼ ਭਰ ਤੋਂ ਵੀ ਖਬਰ ਆਉਂਦੀ ਹੈ ਦੇਸ਼ਾਂ ਵਿਦੇਸ਼ਾਂ 'ਚੋਂ ਵੀ ਆਉਂਦੀਆਂ ਖਬਰਾਂ ਇਹਦੇ ਵਿੱਚ ਅਜੀਤ ਅਖਬਾਰ ਦੇ ਵਿੱਚ ਅਤੇ ਜਾਨੀ ਕਿ ਮਤਲਬ ਅਤੇ ਸਾਰੇ ਦੁਨੀਆਂ ਭਰ ਦੀਆਂ ਖਬਰਾਂ ਆਉਂਦੀਆਂ ਇਹ 'ਚ ਅਤੇ ਦੇਸ਼ਾਂ ਵਿਦੇਸ਼ਾਂ ਵਾਲੀਆਂ ਵੀ ਸਾਰੀਆਂ ਖਬਰਾਂ ਅਤੇ ਸਾਰੇ ਕੋਈ ਧਰਮਾਂ ਬਾਰੇ ਵੀ ਆਉਂਦਾ ਗੁਰ ਪੀਰਾਂ ਬਾਰੇ ਵੀ ਆਉਂਦਾ ਸਾਰਾ ਕੁਛ ਇਹਦੇ ਵਿੱਚ ਦਿੱਤਾ ਜਾਂਦਾ ਗਾ ਵਧੀਆ ਕਿਸੇ ਵੀ ਤਰ੍ਹਾਂ ਦੀ ਵਿਰੋਧਤਾ ਨਹੀਂ ਹੁੰਦੀ ਅਤੇ ਇਸ ਤਰ੍ਹਾਂ ਬਹੁਤ ਵਧੀਆ ਦੱਸਿਆ ਜਾਂਦਾ ਇਹਦੇ ਵਿੱਚ ਸੱਚ ਹੀ ਲਿਖਿਆ ਜਾਂਦਾ ਗਾ ਅਤੇ ਇਹਦੇ ਵਿੱਚ ਹੋਰ ਵੀ ਬਹੁਤ ਤਰ੍ਹਾਂ ਤਰ੍ਹਾਂ ਦੀਆਂ ਖਬਰਾਂ ਆਉਂਦੀਆਂ ਨੇ ਜਿਹੜੀਆਂ ਕਿ ਸੱਚੀਆਂ ਹੁੰਦੀਆਂ ਨੇ ਅਤੇ ਤਾਂ ਕਰਕੇ ਇਹਨੂੰ ਅਜੀਤ ਜਾਨੀ ਕਿ ਰਸਾਲਾ ਇਹ ਅਖਬਾਰ ਮੈਨੂੰ ਬਹੁਤ ਵਧੀਆ ਲੱਗਦਾ ਗਾ ਅਤੇ ਥੈਂਕ ਯੂ ਜੀ ਧੰਨਵਾਦ ਜੀ